ਪੰਦਰਾਂ ਨਵੰਬਰ ਉੱਨੀ ਸੌ ਅੱਸੀ ਤਿੰਨ ਜਨਵਰੀ ਦੋ ਹਜ਼ਾਰ ਵੀਹ ਨੌ ਮਾਰਚ ਦੋ ਹਜ਼ਾਰ ਦਸ ਪੱਚੀ ਜੁਲਾਈ ਦੋ ਹਜ਼ਾਰ ਵੀਹ ਅਗਸਤ ਦੋ ਹਜ਼ਾਰ ਬਾਰਾਂ